ਹਾਂਜੀ ਸਤਿ ਸ਼੍ਰੀ ਅਕਾਲ ਮੈਂ ਆਪਣੇ ਬਾਰੇ ਦੱਸਣਾ ਚਾਹੁੰਦਾ ਹਾਂ ਕਿ ਇੱਕ ਵਾਰ ਮੇਰਾ ਸੋਸ਼ਲ ਮੀਡੀਆ ਦਾ ਅਕਾਊਂਟ ਜੋ ਕਿ ਫੇਸਬੁਕ 'ਤੇ ਕਰੀਬ ਕਰੀਬ ਪੰਦਰਾਂ ਸਾਲ ਪੁਰਾਣਾ ਚਲਦਾ ਪਿਆ ਸੀ ਉਸ ਵਿੱਚ ਬਹੁਤ ਹੀ ਮੇਰੀਆਂ ਘਰ ਦੀਆਂ ਅਤੇ ਆਪਣੇ ਡਿਊਟੀ ਪ੍ਰਤੀ ਜਾਂ ਦਫਤਰੀ ਕੁਛ ਮੇਲ ਅਤੇ ਫੋਟੋਆਂ 'ਤੇ ਕੁਝ ਵੀਡੀਓਜ ਉਸ ਵਿੱਚ ਸੇਵ ਕੀਤੀਆਂ ਹੋਈਆਂ ਸਨ ਪਰ ਇੱਕ ਵਾਰ ਕੀ ਹੋਇਆ ਮੈਂ ਉਸ ਨੂੰ ਜਦੋਂ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਹ ਬਿਲਕੁਲ ਹੀ ਕੋਈ ਫੇਸਬੁਕ ਦਾ ਜੋ ਮੇਰਾ ਆਈ ਡੀ ਸੀਗੀ ਜੋ ਮੇਰਾ ਪਹਿਚਾਣ ਪੱਤਰ ਸੀ ਉਹ ਬਿਲਕੁਲ ਹੀ ਰਿਸਪਾਂਡ ਉਹਦਾ ਕੋਈ ਵੀ ਕਿਸੇ ਤਰ੍ਹਾਂ ਦਾ ਜਵਾਬ ਨਹੀਂ ਆ ਰਿਹਾ ਸੀ ਇੱਕ ਤਰ੍ਹਾਂ ਨਾਲ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਉਹ ਹੈਕ ਹੋ ਗਿਆ ਹੈ ਮੈਂ ਆਪਣੇ ਦੋਸਤ ਨੂੰ ਫੋਨ ਕੀਤਾ ਅਤੇ ਉਸ ਤੋਂ ਪੁੱਛਿਆ ਬਈ ਇਸ ਤਰ੍ਹਾਂ ਕਿਵੇਂ ਹੋ ਗਿਆ ਵੀ ਮੇਰਾ ਤਾਂ ਫੇਸਬੁਕ ਦਾ ਅਕਾਊਂਟ ਮੈਂ ਕਰੀਬ ਤਿੰਨ ਮਹੀਨੇ ਬਾਅਦ ਚਲਾਇਆ ਹੈ ਅਤੇ ਪਰ ਉਹ ਅੱਜ ਖੁੱਲ੍ਹ ਹੀ ਨਹੀਂ ਰਿਹਾ ਪੇਜ ਫਿਰ ਉਸਨੇ ਕੀ ਕੀਤਾ ਕਹਿੰਦਾ ਨਹੀਂ ਤੇਰੇ ਤਾਂ ਅਕਾਊਂਟ ਤੋਂ ਮੈਨੂੰ ਦੋ ਤਿੰਨ ਦਿਨ ਤੋਂ ਮੈਨੂੰ ਪਿਕਚਰਾਂ ਆ ਰਹੀਆਂ ਹਨ ਅਤੇ ਬਿਲਕੁਲ ਬੇਫਜ਼ੂਲ ਤਰ੍ਹਾਂ ਦੀਆਂ ਅਤੇ ਗੰਦੀਆਂ ਤਸਵੀਰਾਂ ਉਸ ਵਿੱਚ ਪਾਈਆਂ ਹੋਈਆਂ ਹਨ ਤੇਰੇ ਘਰ ਬਾਰੇ ਤੇਰੇ ਕੰਮ ਬਾਰੇ ਬਹੁਤ ਕੁਝ ਉਲਟਾ ਸਿੱਧਾ ਲਿਖਿਆ ਹੋਇਆ ਹੈ ਤਾਂ ਉਸ ਤੋਂ ਮੈਨੂੰ ਥੋੜ੍ਹਾ ਜਿਹਾ ਸ਼ੱਕ ਹੋਇਆ ਕਿ ਹਾਂ ਸ਼ਾਇਦ ਇਹ ਮੇਰਾ ਅਕਾਊਂਟ ਹੈਕ ਹੋ ਚੁੱਕਾ ਫਿਰ ਮੈਂ ਕੀ ਕੀਤਾ ਮੈਂ ਕਿਹਾ ਜਲਦਬਾਜ਼ੀ ਵਿੱਚ ਮੈਂ ਆਪਣੇ ਦੋਸਤ ਨੂੰ ਦੋਸਤ ਨੂੰ ਆਪਣੇ ਨਾਲ ਲਿਆ ਅਤੇ ਉਸਨੂੰ ਕਿਹਾ ਆਪਾਂ ਇਸ ਤਰ੍ਹਾਂ ਕਰਦੇ ਹਾਂ ਪਹਿਲਾਂ ਤਾਂ ਆਪਾਂ ਸੌ ਨੰਬਰ 'ਤੇ ਫੋਨ ਕਰਦੇ ਹਾਂ ਅਸੀਂ ਸੌ ਨੰਬਰ 'ਤੇ ਬਹੁਤ ਵਾਰ ਉਸ ਨੂੰ ਕੋਸ਼ਿਸ਼ ਕੀਤੀ ਪਰ ਕਿਸੇ ਨੇ ਫੋਨ ਹੀ ਨਹੀਂ ਚੁੱਕਿਆ ਅਤੇ ਫਿਰ ਅਸੀਂ ਜ ਜਲਦੀ ਕਰਕੇ ਅਸੀਂ ਥਾਣੇ ਗਏ ਪੁਲਿਸ ਸਟੇਸ਼ਨ ਜਾ ਕੇ ਅਸੀਂ ਉੱਥੋਂ ਦੇ ਮੁਨਸ਼ੀ ਨੂੰ ਮਿਲੇ ਅਤੇ ਉਸਨੂੰ ਆਪਣਾ ਸਾਰੀ ਜਾਣਕਾਰੀ ਦਿੱਤੀ ਆਪਣਾ ਆਧਾਰ ਕਾਰਡ ਅਤੇ ਆਈਡੈਂਟੀ ਪਰੂਫ ਦਿਖਾਇਆ ਵੀ ਮੈਂ ਇੱਥੇ ਆਪਣੇ ਕਾਲਜ ਵਿੱਚ ਐਨ ਆਈ ਟੀਚਰ ਨੌਕਰੀ ਕਰਦਾ ਹਾਂ ਅਤੇ ਉਸ ਨੇ ਕਿਹਾ ਕਿ ਸਰਦਾਰ ਜੀ ਤੁਸੀਂ ਇਸ ਨੂੰ ਲਿਖ ਕੇ ਦਿਓ ਸਾਨੂੰ ਕੰਪਲੇਂਟ ਜੋ ਤੁਹਾਡੀ ਹੈ ਅਤੇ ਜੋ ਜੋ ਤੁਹਾਡੇ ਨਾਲ ਵਾਪਰਿਆ ਹੈ ਉਸ ਤੋਂ ਬਿਨਾਂ ਅਸੀਂ ਕੋਈ ਕਾਰਵਾਈ ਨਹੀਂ ਕਰ ਸਕਦੇ ਅਤੇ ਅਸੀਂ ਉਹਨਾਂ ਨੂੰ ਲਿਖ ਕੇ ਦੇ ਦਿੱਤਾ ਅਤੇ ਅਗਲੇ ਦਿਨ ਫਿਰ ਦੁਬਾਰਾ ਤੋਂ ਮੈਂ ਚੈੱਕ ਕੀਤਾ ਅਤੇ ਉਹ ਵਾਕਈ ਹੀ ਮੇਰਾ ਅਕਾਊਂਟ ਰੀਸੈਟ ਕਰਕੇ ਉਹਨਾਂ ਨੇ ਅਤੇ ਉਸ ਨੂੰ ਸਾਰਾ ਕੁਝ ਜੋ ਗਲਤ ਤਸਵੀਰਾਂ ਸਨ ਸਭ ਕੁਝ ਉਹਨਾਂ ਨੇ ਹਟਾ ਦਿੱਤਾ ਸੀ ਅਤੇ ਮੈਂ ਇਸ ਚੀਜ਼ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਅਤੇ ਆਪਣਾ ਧੰਨਵਾਦੀ ਆਪਣੇ ਦੋਸਤ ਦਾ ਵੀ ਹਾਂ ਜਿਸ ਨੇ ਮੈਨੂੰ ਸਹੀ ਗਾਈਡ ਕੀਤਾ ਅਤੇ ਮੈਨੂੰ ਸਹੀ ਰਾਹ ਪਾ ਕੇ ਅਤੇ ਮੇਰਾ ਇਹ ਕਿਸੇ ਵੀ ਤਰ੍ਹਾਂ ਦਾ ਹੋਣ ਵਾਲਾ ਨੁਕਸਾਨ ਤੋਂ ਬਚਾਇਆ ਧੰਨਵਾਦ